ਮੇਰੇ ਪਰਿਵਾਰ ਵਿੱਚ ਅਸੀਂ ਪੰਜ ਮੈਂਬਰ ਹਨ ਮੇਰੇ ਮੰਮੀ ਪਾਪਾ ਮੇਰੇ ਵੱਡੇ ਦੀਦੀ ਅਤੇ ਮੇਰਾ ਛੋਟਾ ਭਰਾ ਸੋ ਅਸੀਂ ਤਿੰਨੋ ਭੈਣ ਭਰਾਵਾਂ ਦੇ ਵਿੱਚ ਅਗਰ ਉਮਰ ਦੀ ਗੈਪ ਦੀ ਗੱਲ ਕਰ ਲਈਏ ਤਾਂ ਦੋ ਦੋ ਸਾਲ ਦਾ ਘੱਟੋੋ ਘੱਟ ਗੈਪ ਹੈ ਮੇਰੇ ਦੀਦੀ ਮੇਰੇ ਤੋਂ ਵੱਡੇ ਹਨ ਜੋ ਕਿ ਵਿਆਹੇ ਹੋਏ ਹਨ ਜਿਹਨਾਂ ਨਾਲ ਅਗਰ ਮੈਂ ਆਪਣੀ ਸਿੰਮਲੈਰਟੀਸ ਦੇਖਾਂ ਤਾਂ ਸਾਡੇ ਨੇਚਰ ਦੇ ਵਿੱਚ ਕਾਫੀ ਜ਼ਿਆਦਾ ਸਿਮਲੈਰਟੀਸ ਹਨ ਅਸੀਂ ਦੋਨੋ ਹੀ ਬਹੁਤ ਔਨੈਸਟ ਹਾਂ ਇੱਕ ਦੂਸਰੇ ਨੂੰ ਲੈ ਕੇ ਜਾਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਪੜ੍ਹਨ ਦੇ ਵਿੱਚ ਕਾਫੀ ਅੱਛੇ ਸਟੂਡੈਂਟ ਰਹੇ ਹੈ ਦੋਨੋ ਹੀ ਆਪਣੀ ਕਲਾਸ ਦੇ ਟੋਪਰ ਰਹੇ ਹਾਂ ਇਸ ਤੋਂ ਇਲਾਵਾ ਮੇਰੇ ਦੀਦੀ ਬਹੁ ਉਹਨਾਂ ਦਾ ਨੇਚਰ ਬਹੁਤ ਜ਼ਿਆਦਾ ਕੇਅਰਿੰਗ ਹੈ ਬਹੁਤ ਜ਼ਿਆਦਾ ਇੱਕ ਦੂਸਰੇ 'ਤੇ ਟਰੱਸਟ ਕਰ ਲੈਂਦੇ ਦੂਜਿਆਂ ਦੇ ਸੋ ਇਹ ਚੀਜ਼ਾਂ ਮੇਰੇ ਵਿੱਚ ਵੀ ਹਨ ਸੋ ਅਗਰ ਮੈਂ ਵਖਰੇਆਂ ਦੀ ਗੱਲ ਕਰਾਂ ਤਾਂ ਮੇਰੇ ਦੀਦੀ ਔਰ ਮੇਰੇ ਵਿੱਚ ਕਾਫੀ ਜ਼ਿਆਦਾ ਵੇਰੀਏਸ਼ਨਸ ਵੀ ਪਾਈਆਂ ਜਾਂਦੀਆਂ ਹਨ ਸਾਡੇ ਨੇਚਰ ਦੇ ਵਿੱਚ ਜਿਵੇਂ ਮੈਨੂੰ ਜਲਦੀ ਗੁੱਸਾ ਆ ਜਾਂਦਾ ਹੈ ਉਹ ਥੋੜ੍ਹੇ ਸ਼ਾਂਤ ਕਿਸਮ ਦੇ ਸ਼ਾਂਤ ਸੁਭਾਅ ਵਾਲੇ ਹਨ ਅਤੇ ਇਸ ਤੋਂ ਇਲਾਵਾ ਉਹ ਚੀਜ਼ਾਂ ਨੂੰ ਜਲਦੀ ਸਮਝ ਲੈਂਦੇ ਹਨ ਮੈਨੂੰ ਕਦੇ ਕਦੇ ਥੋੜ੍ਹਾ ਟਾਇਮ ਲੱਗਦਾ ਹੈ ਇਸ ਤੋਂ ਉਲਟ ਅਗਰ ਮੈਂ ਆਪਣੇ ਭਰਾ ਨਾਲ ਆਪਣਾ ਕੰਪੈਰੀਜ਼ਨ ਕਰਾਂ ਤਾਂ ਮੇਰਾ ਭਰਾ ਵੈਸੇ ਮੇਰੇ ਤੋਂ ਛੋਟਾ ਹੈ ਪਰ ਅਸੀਂ ਦੋਨਾਂ ਦਾ ਹੀ ਪਿਆਰ ਇੱਕ ਦੂਸਰੇ ਲਈ ਬਹੁਤ ਜ਼ਿਆਦਾ ਹੈ ਪਰ ਅਸੀਂ ਲੜਦੇ ਵੀ ਬਹੁਤ ਜ਼ਿਆਦਾ ਹਨ ਸੋ ਸੁਭਾਅ ਦੀ ਗੱਲ ਕਰ ਲਈਏ ਤਾਂ ਅਸੀਂ ਦੋਨੋ ਹੀ ਗੁੱਸੇਖੋਰ ਹਾਂ ਸਾਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ ਅਤੇ ਅਸੀਂ ਕਹਿ ਸਕਦੇ ਹਾਂ ਕੇ ਸਮਾਨਤਾ ਦੇ ਵਿੱਚ ਵੀ ਸੇਮ ਹੈ ਕਿ ਉਹ ਵੀ ਪੜ੍ਹਨ ਦੇ ਵਿੱਚ ਕਾਫੀ ਹੁਸ਼ਿਆਰ ਸੀ ਅਤੇ ਮੈਂ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀਗੀ ਅ ਇਸ ਤੋਂ ਇਲਾਵਾ ਮੇਰਾ ਭਰਾ ਜੋ ਹੈ ਉਹ ਕਦੇ ਕਦੇ ਕੰਮ ਚੋਰ ਕਹਿ ਸਕਦੇ ਹਾਂ ਕੇ ਉਹ ਥੋੜ੍ਹਾ ਆਲਸੀ ਹੈ ਉਹਨੂੰ ਕੰਮ ਘੱਟ ਕਰਨਾ ਪਸੰਦ ਹੈ ਪਰ ਮੈੈਂ ਇਸ ਤੋਂ ਉਲਟ ਬਿਲਕੁਲ ਐਕਟਿਵ ਹਾਂ ਔਰ ਮੈਨੂੰ ਕੰਮ ਕਰਨਾ ਜ਼ਿਆਦਾ ਪਸੰਦ ਹੈ ਆਪਣਾ ਕੰਮ ਕਰਦੇ ਰਹਿਣਾ ਜੋਬ ਕਰਨੀ ਹੈ ਜਾਂ ਘਰ ਦੇ ਕੋਈ ਵੀ ਕੰਮ ਕਰਨੇ ਹੈ ਸੋ ਸਾਰੀਆਂ ਚੀਜਾਂ ਮੈਨੂੰ ਪਸੰਦ ਹੈ ਬਲ ਜਦੋਂ ਕਿ ਮੇਰੇ ਬਰਾ ਭਰਾ ਨੂੰ ਉਹ ਚੀਜ਼ਾਂ ਬਿਲਕੁਲ ਪਸੰਦ ਨਹੀਂ ਹੈ ਸੋ ਉਹ ਹਮੇਸ਼ਾ ਆਪਣੇ ਬੈਡ 'ਤੇ ਉਹਨੂੰ ਲੇਟਣਾ ਪਸੰਦ ਹੈ ਫੋਨ ਚਲਾਉਣਾ ਪਸੰਦ ਹੈ ਆਪਣੇ ਫਰੈਂਡਸ ਦੇ ਨਾਲ ਗੱਲਾਂ ਕਰਨੀਆਂ ਪਸੰਦ ਹੈ ਟੀ ਵੀ ਦੇਖਣਾ ਜ਼ਿਆਦਾ ਉਹਨੂੰ ਅੱਛਾ ਲੱਗਦਾ ਹੈ ਸੋ ਮੇਰੇ ਐਵੇਂ ਦੇ ਕੋਈ ਵੀ ਹੋਬੀਸ ਨਹੀਂ ਹੈ ਸੋ ਮੈਂ ਕਹਿ ਸਕਦੀ ਹਾਂ ਕੇ ਮੇਰੇ ਮੇਰੇ ਭਰਾ ਔਰ ਮੇਰੇ ਦੀਦੀ ਦੇ ਸੁਭਾਅ ਦੇ ਵਿੱਚ ਕਾਫੀ ਜ਼ਿਆਦਾ ਸਿਮਲੈਰਟੀਜ਼ ਵੀ ਹਨ ਅਤੇ ਬਹੁਤ ਜ਼ਿਆਦਾ ਵਖਰੇਵੇਂ ਵੀ ਪਾਏ ਜਾਂਦੇ ਹਨ